ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਦੁਕਾਨ ਤੋਂ ਮੇਕਅਪ ਕਿੱਟ ਔਨਲਾਈਨ ਮੰਗਵਾਈ ਸੀ ਇੱਕ ਤਾਂ ਇਹ ਮੈਨੂੰ ਬਹੁਤ ਲੇਟ ਮਿਲੀ ਦੂਜੀ ਇਹਦੀ ਪੈਕਿੰਗ ਤਾਂ ਚਲੋ ਠੀਕ ਸੀ ਪਰ ਜਦੋਂ ਮੈਂ ਇਹ ਖੋਲ੍ਹੀ ਇਹਦੇ ਵਿੱਚ ਸਮਾਨ ਵੀ ਪੂਰਾ ਨਹੀਂ ਸੀ ਜੋ ਜੋ ਤੁਸੀਂ ਦੱਸਿਆ ਸੀ ਅਤੇ ਫਿਰ ਵੀ ਮੈਂ ਸੋਚਿਆ ਵੀ ਇਹਨੂੰ ਵਰਤ ਕੇ ਦੇਖਦੀ ਐਂ ਜਦੋਂ ਮੈਂ ਇਹਨੂੰ ਵਰਤਿਆ ਤਾਂ ਮੇਰਾ ਸਾਰਾ ਚਿਹਰਾ ਖਰਾਬ ਹੋ ਗਿਆ ਸਾਰਾ ਛਾਈਆਂ ਦਾਗ ਰੰਗ ਵੀ ਕਾਲ਼ਾ ਹੋ ਗਿਆ ਅਤੇ ਮੈਨੂੰ ਬੜਾ ਦੁੱਖ ਹੋਇਆ ਮੈਂ ਇੰਨੇ ਪੈਸੇ ਲਗਾਏ ਫਿਰ ਵੀ ਮੈਨੂੰ ਕੋਈ ਰਿਜ਼ਲਟ ਵਧੀਆ ਨਹੀਂ ਮਿਲਿਆ ਅਤੇ ਹੁਣ ਮੈਂ ਇਹ ਤੁਹਾਡਾ ਪ੍ਰੋਡਕਟ ਵਾਪਸ ਕਰਨਾ ਚਾਹੁੰਦੀ ਹਾਂ ਮੈਂ ਤਾਂ ਸੋਚਿਆ ਸੀ ਵੀ ਚਲੋ ਇੰਨੀ ਐਡ ਆਈ ਹੈ ਤੁਹਾਡੀ ਵਧੀਆ ਹੀ ਹੋਣਾ ਏ ਹੈ ਨਾ ਪਰ ਬਿਲਕੁਲ ਵੀ ਮੈਨੂੰ ਪਸੰਦ ਨਹੀਂ ਆਇਆ ਇਹ ਮੈਂ ਤੁਹਾਡਾ ਇਹ ਪ੍ਰੋਡਕਟ ਹੁਣ ਵਾਪਸ ਕਰਨਾ ਏ